ਭਾਰਤ ਇੱਕ ਸੱਭਿਆਚਾਰਿਕ ਵਿਭਿੰਨਤਾ ਵਾਲਾ ਦੇਸ਼ ਹੈ ਇੱਥੋਂ ਦੇ ਹਰ ਇੱਕ ਰਾਜ ਦੀ ਆਪੋ ਆਪਣੀ ਸੱਭਿਆਚਾਰਕ ਪੋਸ਼ਾਕ ਹੈ ਪਹਿਲਾਂ ਕੀ ਹੁੰਦਾ ਸੀਗਾ ਕਿ ਹਰ ਇੱਕ ਕਿਸੇ ਵੀ ਰਾਜ ਦੇ ਇਨਸਾਨ ਦੀ ਆਪਾਂ ਕਹਿ ਲਓ ਕਿ ਪਹਿਚਾਣ ਜਿਹੜੀ ਹੈਗੀ ਹੈ ਉਹਦੀ ਪੋਸ਼ਾਕ ਤੋਂ ਕਰ ਸਕਦੇ ਹਾਂ ਪਰ ਇਹ ਪੋਸ਼ਾਕ ਜਿਹੜੀ ਹੈ ਅੱਜ ਕੱਲ੍ਹ ਸੀਮਾਬਧ ਨਹੀਂ ਰਹਿ ਗਈ ਕਿਸੇ ਵੀ ਰਾਜ ਦੇ ਇਨਸਾਨ ਨੂੰ ਜਾਂ ਕਿਸੇ ਵੀ ਰਾਜ ਦਾ ਕੋਈ ਵੀ ਬੰਦਾ ਕਿਸੇ ਦੂਜੇ ਰਾਜ ਦੀ ਪੋਸ਼ਾਕ ਜਿਹੜੀ ਹੈ ਉਹ ਵੀ ਪਾ ਸਕਦਾ ਪਹਿਲਾਂ ਦੇ ਮੁਕਾਬਲੇ ਕੱਪੜੇ ਜਿਹੜੇ ਨੇ ਉਹ ਬਹੁਤ ਹੀ ਬਦਲੇ ਹੋਏ ਨੇ ਕਿ ਪਹਿਲਾਂ ਆਪਾਂ ਜਿਵੇਂ ਕਹਿ ਲਓ ਸਿਰਫ਼ ਕਿਸੇ ਇੱਕ ਰਾਜ ਦੇ ਵਿੱਚ ਹੀ ਜਿਵੇਂ ਸਾੜੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨੂੰ ਸਿਰਫ਼ ਪਹਿਲਾਂ ਮੱਧਿਆ ਪ੍ਰਦੇਸ਼ ਜਾਂ ਇਹੋ ਜਿਹੇ ਰਾਜਾਂ ਦੇ ਵਿੱਚ ਹੀ ਪਾਇਆ ਜਾਂਦਾ ਸੀ ਪਰ ਅੱਜ ਕੱਲ੍ਹ ਅਜਿਹਾ ਕੁਛ ਵੀ ਨਹੀਂ ਰਿਹਾ ਪੱਛਮੀ ਫੈਸ਼ਨ ਨੇ ਭਾਰਤ ਵਿੱਚ ਫੈਸ਼ਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਆਪਾਂ ਪਹਿਲਾਂ ਦੇਖੀਏ ਤਾਂ ਆਪਾਂ ਟੀ ਵੀ ਦੇ ਉੱਪਰ ਹੀ ਸਿਰਫ਼ ਜੀਨ ਟੋਪ ਵਰਗੇ ਜਿਹੜੇ ਕੱਪੜੇ ਸੀਗੇ ਉਹ ਹੀਰੋ ਹੀਰੋਇਨਜ਼ ਨੂੰ ਪਾਉਂਦਿਆਂ ਦੇਖੀ ਦਾ ਸੀ ਪਰ ਅੱਜ ਕੱਲ੍ਹ ਕੀ ਹੈਗਾ ਹੈ ਇਹ ਆਮ ਹੀ ਪਹਿਰਾਵਾ ਬਣ ਚੁੱਕਾ ਹੈ ਅੱਜ ਕੱਲ੍ਹ ਬਹੁਤ ਫੇਮਸ ਨੇ ਟਰੈਂਡ ਦੇ ਵਿੱਚ ਚੱਲ ਰਹੇ ਨੇ ਕੱਪੜੇ ਜਿਨ੍ਹਾਂ ਨੂੰ ਆਪਾਂ ਇੰਡੋ ਵੈਸਟਰਨ ਕਹਿ ਦਿੰਦੇ ਨੇ ਇਹਨਾਂ ਦੇ ਵਿੱਚ ਕੀ ਹੁੰਦਾ ਹੈ ਭਾਰਤੀ ਸਭਿਆਚਾਰਿਕਤਾ ਨੂੰ ਨਾਲ ਲੈ ਕੇ ਥੋੜ੍ਹਾ ਇਹਦੇ ਵਿੱਚ ਪੱਛਮੀ ਸੱਭਿਆਚਾਰ ਦਾ ਵੀ ਟੱਚ ਦਿੱਤਾ ਹੁੰਦਾ ਹੈ ਕੱਪੜਿਆਂ ਦਾ ਮੈਨੂੰ ਸਾਦੇ ਸਿੰਪਲ ਕੱਪੜੇ ਪਹਿਨਣਾ ਪਸੰਦ ਹੈ ਇਹਨਾਂ ਇਸਦਾ ਮਤਲਬ ਇਹ ਨਹੀਂ ਕਿ ਮੈਂ ਇਹ ਜੀਨ ਟੋਪ ਹੋ ਗਿਆ ਜਾਂ ਸਾੜੀ ਵਗੈਰਾ ਹੋ ਗਿਆ ਇਹਨੂੰ ਬਿਲਕੁਲ ਵੀ ਪਹਿਨਦੀ ਨਹੀਂ ਹਾਂ ਹਾਂ ਮੈਂ ਹਰ ਤਰੀਕੇ ਦਾ ਕੱਪੜਾ ਜਿਹੜਾ ਹੈ ਉਹਨੂੰ ਪਹਿਨ ਲੈਂਦੀ ਹਾਂ ਪਰ ਮੇਰਾ ਉਹਨਾਂ ਨੂੰ ਪਹਿਨਣ ਦਾ ਆਪਣਾ ਇੱਕ ਢੰਗ ਹੈ ਅਸੀਂ ਉਸ ਤੋਂ ਦੁਕਾਨ ਤੋਂ ਵੀ ਖਰੀਦਦੇ ਹਾਂ ਕਈ ਕੱਪੜੇ ਜਿਹੜੇ ਨੇ ਉਹ ਮੋਲ ਤੋਂ ਵੀ ਖਰੀਦੇ ਨੇ